ਸਮਕਾਲੀ ਪੰਜਾਬੀ ਲੇਖਕਾਂ ਵਿੱਚ ਕੁਝ ਲੇਖਕ ਅਜਿਹੇ ਹਨ ਜਿਹਨਾਂ ਦੀ ਲਿਖਤ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਇਹਨਾਂ ਦੀ ਕਵਿਤਾਵਾਂ ਬਹੁਤ ਹੀ ਜ਼ਿਆਦਾ ਪ੍ਰਸਿੱਧ ਹਨ ਜੋ ਕਿ ਲੋਕਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦੀ ਹੈ ਇਹਨਾਂ ਦੀ ਲਿਖਤ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਜ਼ਿਆਦਾ ਸੁਚੱਜੀ ਹੈ ਜਿਸ ਵਿੱਚ ਉਹਨਾਂ ਨੇ ਹਰ ਇੱਕ ਤਰ੍ਹਾਂ ਦੇ ਟੋਪਿਕ ਨੂੰ ਵਿੱਚ ਰੱਖਿਆ ਹੈ ਉਹਨਾਂ ਨੇ ਆਪਣੀ ਕਵਿਤਾਵਾਂ ਵਿੱਚ ਕੁਝ ਅਜਿਹੀਆਂ ਗੱਲਾਂ ਲਿਖੀਆਂ ਹਨ ਜਿਹਨਾਂ ਨੂੰ ਲੋਕ ਬਹੁਤ ਹੀ ਜ਼ਿਆਦਾ ਮੰਨਦੇ ਹਨ ਅਤੇ ਉਹਨਾਂ ਨੇ ਲਿਖਿਆ ਹੈ ਜਿੱਦਾਂ ਕਿ ਲੋਕ ਪੰਜਾਬੀਅਤ ਨੂੰ ਰਫਾ ਕਰ ਰਹੇ ਹਨ ਲੋਕ ਬਾਹਰ ਜਾ ਕੇ ਅਮਰੀਕਾ ਕਨੇਡਾ ਵਸ ਜਾਂਦੇ ਹਨ ਉਹਨਾਂ ਨੂੰ ਪੰਜਾਬੀਅਤ ਦਾ ਇੰਨਾ ਪਤਾ ਨਹੀਂ ਹੈ ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਪੰਜਾਬੀ ਨੂੰ ਇਸ ਤਰ੍ਹਾਂ ਪਰੋ ਕੇ ਰੱਖਿਆ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਇੰਨੀਆਂ ਚੰਗੀਆਂ ਲੱਗਦੀਆਂ ਹਨ ਉਹਨਾਂ ਦੀਆਂ ਕਿਤਾਬਾਂ ਨੂੰ ਲੋਕ ਪੜ੍ਹਦੇ ਹਨ ਅਤੇ ਉਹਨਾਂ 'ਤੇ ਅਮਲ ਵੀ ਕਰਦੇ ਹਨ ਇਹਨਾਂ ਦੀਆਂ ਕਵਿਤਾਵਾਂ ਕੁਝ ਅਜਿਹੀਆਂ ਹਨ ਕਿ ਲੋਕਾਂ ਨੂੰ ਪੜ੍ਹ ਕੇ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਇਹ ਲੋਕ ਸ਼ਿਵ ਕੁਮਾਰ ਬਟਾਲਵੀ ਦੀਆਂ ਕਿਤਾਬਾਂ ਖਰੀਦ ਖਰੀਦ ਕੇ ਰੱਖਦੇ ਹਨ ਤਾਂ ਕਿ ਉਹਨਾਂ ਨੂੰ ਪੰਜਾਬੀਅਤ ਬਾਰੇ ਹੋਰ ਕੁਝ ਵੀ ਪਤਾ ਲੱਗ ਸਕੇ ਪੰਜਾਬੀ ਭਾਸ਼ਾ ਬਾਰੇ ਹੋਰ ਵੀ ਪਤਾ ਲੱਗ ਸਕੇ ਪੰਜਾਬੀ ਭਾਸ਼ਾ 'ਚ ਅਜਿਹੇ ਲਫਜ਼ ਹਨ ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਨਹੀਂ ਵਰਤੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੇ ਕਿਤਾਬਾਂ ਦੇ ਵਿੱਚ ਅਜਿ ਅਜਿਹੇ ਲਫਜ਼ ਯੂਜ ਕੀਤੇ ਹਨ ਜਿਹਨਾਂ ਦੀ ਵਰਤੋਂ ਅੱਜ ਕੱਲ੍ਹ ਦੇ ਸਮੇਂ ਵਿੱਚ ਨਹੀਂ ਕੀਤੀ ਗਈ ਪਰੰਤੂ ਇਹਨਾਂ ਦੀ ਵਰਤੋਂ ਬਹੁਤ ਹੀ ਆਮ ਹੈ ਲੋਕ ਅੱਜ ਕੱਲ੍ਹ ਦੂਸਰੀਆਂ ਭਾਸ਼ਾਵਾਂ ਵਿੱਚ ਜ਼ਿਆਦਾ ਅਸਰ ਕਰਦੇ ਹਨ ਪਰੰਤੂ ਪੰਜਾਬੀ ਭਾਸ਼ਾ ਨੂੰ ਬਹੁਤ ਘੱਟ ਮੰਨਦੇ ਹਨ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀਆਂ ਕਵਿਤਾਵਾਂ ਪੰਜਾਬੀ ਵਿੱਚ ਇਸ ਲਈ ਲਿਖੀਆਂ ਹਨ ਤਾਂ ਕਿ ਉਹ ਪੰਜਾਬੀ ਨੂੰ ਜਿੰਦਾ ਰੱਖ ਸਕਣ